ਸਪੀਕ ਆਊਟ ਦਾ ਫੋਲਿੰਗ ਨੇਮ ਆਫ ਵਹੀਕਲ ਹਿੰਟ ਐਸਟਨ ਮਾਕਤੇਲ ਡੀ ਬੀ ਆਰ ਟਵੇਂਟੀ ਟੂ ਅਵੋਰਥ ਸਿਮਿਕਾ ਜੀ ਟੀ ਇਨ ਫੇਰੀਨੋ ਐਕਸੋਟਿਕ ਕਾਰ